ਹੈਲੋ ਹਾਂਜੀ ਨਮਸਕਾਰ ਸਰ ਹਾਂਜੀ ਸਰ ਮੈਂ ਨਾ ਤੁਹਾਡੇ ਹੋਸਪਿਟਲ ਐਡਮਿਟ ਸੀ ਦਸ ਨਵੰਬਰ ਨੂੰ ਨਾ ਦਸ ਨਵੰਬਰ ਤੋਂ ਲੈ ਕੇ ਚੌਦਾਂ ਨਵੰਬਰ ਤੱਕ ਇੱਕ ਤਾਂ ਸਰ ਉਹਨਾਂ ਨੇ ਹੋਸਪਿਟਲ ਵਾਲਿਆਂ ਨੇ ਐਕਸਟਰਾ ਚਾਰਜਸ ਲਏ ਨਾ ਰੂਮ ਤੇ ਉਹਨਾਂ ਨੇ ਫੌਰਟੀ ਫਾਇਵ ਹਨ੍ਡਰ੍ਡ ਕਿਹਾ ਸੀ ਬਟ ਫਾਇਵ ਥਾਉਜ਼ਨ੍ਡ ਲਿਆ ਵਨ ਨਾਇਟ ਦਾ ਔਰ ਉਹਨਾਂ ਨੇ ਕਿਹਾ ਸੀ ਕਿ ਡਾਕਟਰ ਦੀ ਵਿਜਿਟ ਵੀ ਇਨਕਿਲੁਡ ਹੋਏਗੀ ਉਹਦੇ ਵੀ ਐਕਸਟਰਾ ਚਾਰਜਸ ਪਾਏ ਹੋਏ ਨੇ ਉਦੋਂ ਤਾਂ ਅਸੀਂ ਚਲੋ ਅਸੀਂ ਡਿਸਚਾਰਜ ਲੈ ਲਿਆ ਬਟ ਹੁਣ ਦੇਖਿਆ ਤਾਂ ਮਤਲਬ ਐਕਸਟਰਾ ਚਾਰਜਸ ਲੱਗੇ ਹੋਏ ਆ ਹਾਂਜੀ ਹਾਂਜੀ ਹਾਂਜੀ ਹਾਂਜੀ ਨਾਇਨ ਟ੍ਰੀਪਲ ਏਟ ਫੌਰ ਵਨ ਫਾਇਵ ਫੌਰ ਟੂ ਨਾਇਨ ਹਾਂਜੀ ਹਾਂਜੀ ਸਰ ਮੈਂ ਇਸੀ ਪੇਸ਼ਂਟ ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਓਕੇ ਪਰ ਸਰ ਤੁਸੀਂ ਦੱਸ ਸਕਦੇ ਹੋ ਕਿ ਮੈਂ ਤੁਹਾਡੀ ਰੀਫੰਡ ਕਿਵੇਂ ਲੈ ਸਕਦੀ ਹੈ ਕਿਉਂਕਿ ਰੂਮ ਦੇ ਚਾਰਜਸ ਦਾ ਐਕਸਟਰਾ ਪਏ ਹੋਏ ਆ ਨਾ ਸਰ ਹਾਂਜੀ ਓਕੇ ਠੀਕ ਹੈ ਸਰ ਠੀਕ